ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਦਾਰ ਜੀ ਹਾਂ ਕਿਵੇਂ ਹੋ ਅੱਛਾ ਚਲੋ ਠੀਕ ਆ ਮੈਂ ਤੁਹਾਨੂੰ ਨਾ ਕਹਿਣਾ ਸੀਗਾ ਕਿ ਖਾਣਾ ਜਿਹੜਾ ਤੁਸੀਂ ਅੱਜ ਕੱਲ੍ਹ ਬਣਾ ਰਹੇ ਹੋ ਨਾ ਇਹ ਉਹ ਮਤਲਬ ਅੱਛਾ ਨਹੀਂ ਬਣ ਰਿਹਾ ਕਿ ਮਤਲਬ ਕਹਿ ਲਓ ਕਿ ਕੱਲ੍ਹ ਦੀ ਦਾਲ ਵੀ ਕੱਚੀ ਸੀਗੀ ਨਾ ਕੋਈ ਸਲਾਦ ਕੱਟਿਆ ਨਾ ਕੋਈ ਮਤਲਬ ਬੱਚਿਆਂ ਨੂੰ ਖਾਣ ਨੂੰ ਕੋਈ ਫਰੂਟ ਸੀਗਾ ਅਤੇ ਤੁਸੀਂ ਆਪਣਾ ਕੰਮ ਜਰਾ ਮਤਲਬ ਵਧੀਆ ਤਰੀਕੇ ਨਾਲ ਕਰੋ ਉਹ ਗੱਲ ਰਹਿ ਨਹੀਂ ਗਈ ਹੁਣ ਨਹੀਂ ਨਹੀਂ ਦੋ ਤਿੰਨ ਦਿਨ ਤੋਂ ਤਾਂ ਬਹੁਤ ਦੋ ਤਿੰਨ ਦਿਨ ਤੋਂ ਤਾਂ ਬਹੁਤ ਔਖਾ ਹੋ ਰਿਹਾ ਕਿ ਆਪਣਾ ਸਾਰਾ ਕੁਝ ਮਤਲਬ ਹੋਚ ਪੋਚ ਹੋ ਰਿਹਾ ਨਾ ਕੋਈ ਸੈਲਡ ਹੁੰਦੀ ਹੈ ਚਪਾਤੀਆਂ ਵੀ ਆਟਾ ਮਤਲਬ ਕਿ ਕੱਚਾ ਹੀ ਹੁੰਦਾ ਆ ਕੱਲ੍ਹ ਚਾਵਲ ਬਣੇ ਸੀ ਉਹ ਵੀ ਕੱਚੇ ਨਿਕਲੇ ਵਿੱਚੋਂ ਅਤੇ ਬੱਚੇ ਵੀ ਕਿਚ ਕਿਚ ਕਰਦੇ ਰਹਿੰਦੇ ਆ ਵੀ ਅਸੀਂ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਅੱਛਾ ਨਹੀਂ ਟੇਸਟੀ ਨਹੀਂ ਹੈ ਕਦੇ ਨਮਕ ਘੱਟ ਹੈ ਕਦੇ ਜ਼ਿਆਦਾ ਆ ਅਤੇ ਬਿਲਕੁਲ ਵੀ ਅੱਛਾ ਨਹੀਂ ਲੱਗਦਾ ਹੈਗਾ ਸਾਰਾ ਕੁਛ ਹੁਣ ਮੈਂ ਤੁਹਾਨੂੰ ਕੰਪਲੇਂਟ ਕਰ ਰਹੀ ਪਰ ਅੱਛੀ ਗੱਲ ਨਹੀਂ ਪਰ ਤੁਸੀਂ ਧਿਆਨ ਰੱਖੋ ਅੱਗੇ ਤੋਂ ਹੈ ਨਾ ਹਾਂ ਬੱਚਿਆਂ ਦੇ ਟਿਫਨ ਦਾ ਵੀ ਸਵੇਰੇ ਵਧੀਆ ਜਿਹਾ ਮਤਲਬ ਪੈਕਿੰਗ ਦਾ ਕਰ ਲਿਆ ਕਰੋ ਵੀ ਅੱਛਾ ਉਹਨਾਂ ਨੂੰ ਖਾਣ ਨੂੰ ਮਿਲ ਜਾਵੇ ਅਤੇ ਆਰਾਮ ਨਾਲ ਬੱਚੇ ਸਕੂਲ ਤੋਂ ਕਰ ਲੈਣ ਨਾਸ਼ਤਾ ਵਗੈਰਾ ਅੱਛੀ ਤਰ੍ਹਾਂ ਹੈ ਨਾ ਚਲੋ ਠੀਕ ਹੈ ਅੱਗੇ ਤੋਂ ਆਪਣਾ ਧਿਆਨ ਰੱਖਿਓ ਅਤੇ ਜੋ ਵੀ ਰਾਸ਼ਨ ਪਾਣੀ ਮੁੱਕਿਆ ਹੁੰਦਾ ਪਹਿਲਾਂ ਲਿਸਟ ਬਣਾ ਦਿਆ ਕਰੋ ਵੀ ਤਾਂ ਜੋ ਮਤਲਬ ਹੈ ਨਾ ਪਤਾ ਲੱਗ ਜਾਵੇ ਠੀਕ ਹੈ ਹੋਰ ਚਲੋ ਠੀਕ ਹੈ ਫਿਰ ਆਪਾਂ ਕੱਲ੍ਹ ਮਿਲਦੇ ਹਾਂ ਤਾਂ ਫਿਰ ਤੁਸੀਂ ਮੈਨੂੰ ਸਾਰਾ ਕੁਛ ਦੇ ਦਿਓ ਲਿਸਟ ਵਗੈਰਾ ਬਣਾ ਕੇ ਠੀਕ ਹੈ ਚਲੋ ਹੋਰ ਘਰ 'ਚ ਕਿੱਦਾਂ ਸਭ ਠੀਕ ਹੈ ਚਲੋ ਠੀਕ ਹੈ ਤੁਸੀਂ ਆਪਣਾ ਖਿਆਲ ਰੱਖੋ ਅਤੇ ਇਹ ਸਾਰੀ ਕੰਪਲੇਂਟ ਜਿਹੜੀ ਮੈਂ ਤੁਹਾਨੂੰ ਕੀਤੀ ਹੈ ਅਤੇ ਉਹ ਨੋਟ ਕਰ ਲੈਣਾ ਅੱਗੇ ਤੋਂ ਇਹ ਚੀਜ਼ਾਂ ਨਾ ਹੋਣ ਦੁਬਾਰਾ ਠੀਕ ਹੈ ਚਲੋ ਠੀਕ ਹੈ ਫਿਰ ਓਕੇ ਬਾਏ